ਹੈਲੋ ਹਾਂਜੀ ਅਸੀਂ ਇੱਕ ਪ੍ਰੋਡਕਟ ਦੀ ਡਿਮਾਂਡ ਕੀਤੀ ਸੀਗੀ ਬੋਡੀ ਵਾਸ ਲੋਸ਼ਨ ਦੀ ਉਹ ਪ੍ਰੋਡਕਟ ਦੇ ਵਿੱਚ ਪਹਿਲਾਂ ਤਾਂ ਅਸੀਂ ਸਰਚ ਕੀਤੀ ਫਲਿੱਪਕਾਡ ਐਮੇਜੋਨ ਮੀਸ਼ੋ ਜਿੰਨੀਆਂ ਵੀ ਇਹ ਐਪਸ ਨੇ ਸਾਰਿਆਂ 'ਤੇ ਸਰਚ ਕਰੀ ਵੀ ਕਿੱਥੋਂ ਸਾਨੂੰ ਵਧੀਆ ਇਹ ਪ੍ਰੋਡਕਟ ਮਿਲ ਸਕਦਾ ਕਾਫ਼ੀ ਦਿਨ ਅਸੀਂ ਲੱਗੇ ਰਹੇ ਇਹਦੇ 'ਤੇ ਸਰਚ ਕਰਦੇ ਰਹੇ ਵੀ ਬੋਡੀ ਨੂੰ ਤੰਦਰੁਸਤ ਰੱਖਣ ਵਾਸਤੇ ਕਿਸ ਕੋਂਪਣੀ ਦਾ ਅਸੀਂ ਬੋਡੀ ਲੋਸ਼ਨ ਮੰਗਾਈਏ ਔਰ ਕਿੱਥੋਂ ਮੰਗਾਈਏ ਕਾਫ਼ੀ ਦੋਸਤਾਂ ਮਿੱਤਰਾਂ ਨਾਲ ਵੀ ਅਸੀਂ ਵਿਚਾਰ ਸਾਂਝੇ ਕੀਤੇ ਉਨ੍ਹਾਂ ਨੂੰ ਅਸੀਂ ਆਪਣੀ ਬੋਡੀ ਦੀ ਪ੍ਰੋਬਲਮ ਬਾਰੇ ਦੱਸਿਆ ਵੀ ਕਿਹੜੀ ਕੋਂਪਣੀ ਦਾ ਲਈਏ ਅਸੀਂ ਕਿੱਥੋਂ ਮੰਗਵਾਈਏ ਅਸੀਂ ਉਹਦੇ ਚਾਰਜਸ ਵਗੈਰਾ ਕੀ ਆ ਉਹਦੀ ਕੋਸਟ ਕੀ ਆ ਵਧੀਆ ਕੁਆਲਟੀ ਦਾ ਅਤੇ ਸਸਤਾ ਜਿਹੜਾ ਸਾਨੂੰ ਉਹ ਕਿੱਥੋਂ ਮਿਲੂਗਾ ਇਹ ਸਾਰਾ ਕੁਛ ਅਸੀਂ ਸੋਚ ਵਿਚਾਰ ਕਰਨ ਤੋਂ ਬਾਅਦ ਦੇ ਵਿੱਚ ਦੋਸਤਾਂ ਮਿੱਤਰਾਂ ਨੇ ਵੀ ਸਰਚ ਕੀਤੀ ਅਸੀਂ ਵੀ ਸਰਚ ਕੀਤੀ ਸਾਡੇ ਪਰਿਵਾਰ ਦੇ ਵਿੱਚ ਹੋਰ ਮੈਂਬਰਾਂ ਵੀ ਸਰਚ ਕੀਤੀ ਅਸੀਂ ਫਿਰ ਬਾਅਦ ਦੇ ਵਿੱਚ ਕਿ ਰਿਜਲਟ ਇਹ ਕੱਢਿਆ ਵੀ ਅਸੀਂ ਲਕਸ ਦਾ ਜਿਹੜਾ ਬੋਡੀ ਵਾਸ ਲੋਸ਼ਨ ਇਹ ਮੰਗਾਈਏ ਇਹ ਵਧੀਆ ਕੁਆਲਟੀ ਆ ਇਸ ਦਾ ਰੇਟ ਵੀ ਸਹੀ ਹੈ ਇਹ ਸਾਰਾ ਕੁਛ ਕਰਨ ਤੋਂ ਬਾਅਦ 'ਚ ਅਸੀਂ ਐਮਾਜੋਨ ਦੀ ਸਿਲੈਕਸ਼ਨ ਕੀਤੀ ਸਾਨੂੰ ਹੋਰ ਵੀ ਸਾਡੇ ਸਲਾਹਕਾਰਾਂ ਨੇ ਦੱਸਿਆ ਇੱਕ ਤਾਂ ਵੀ ਉਹਦੀ ਕੁਆਲਟੀ ਵਧੀਆ ਇੱਕ ਉਹਦਾ ਰੇਟ ਵਧੀਆ ਅਸੀਂ ਉਨ੍ਹਾਂ ਨੂੰ ਓਡਰ ਸਪਲਾਈ ਕਰਤਾ ਓਡਰ ਸਪਲਾਈ ਕਰਨ ਦੇ ਵਿੱਚ ਜਿਹੜੇ ਉਨ੍ਹਾਂ ਦੇ ਨੈਗੇਟਿਵ ਪੁਆਇੰਟ ਆਏ ਆ ਉਹ ਇਸ ਪ੍ਰਕਾਰ ਨੇ ਇੱਕ ਤਾਂ ਜਿਹੜਾ ਅਸੀਂ ਡਿਮਾਂਡ ਕੀਤੀ ਹੈ ਉਹ ਓਡਰ ਸਾਨੂੰ ਸਪਲਾਈ ਦੇਣ ਤੱਕ ਉਨ੍ਹਾਂ ਨੇ ਬਹੁਤ ਦੇਰ ਕੀਤੀ ਅੱਜ ਇੱਥੋਂ ਚੱਲ ਪਿਆ ਜੀ ਫਲਾਣੀ ਜਗ੍ਹਾ 'ਤੇ ਪਹੁੰਚ ਗਿਆ ਐਂ ਕਰਦੇ ਕਰਦੇ ਉਨ੍ਹਾਂ ਨੇ ਜਿਹੜਾ ਦੋ ਦਿਨ ਦਾ ਟੈਮ ਦਿੱਤਾ ਸੀ ਉਹ ਲੇਟ ਪਹੁੰਚਿਆ ਸਾਡੇ ਕੋਲ ਸੈਕੰਡਲੀ ਉਸਦਾ ਰੇਟ ਮਹਿੰਗਾ ਸੀਗਾ ਤੀਜਾ ਜਦੋਂ ਅਸੀਂ ਉਹਦਾ ਬੋਡੀ ਲੋਸ਼ਨ ਜਦੋਂ ਅਸੀਂ ਇਸਤੇਮਾਲ ਕੀਤਾ ਤਾਂ ਉਹਦੇ ਸਾਨੂੰ ਕੁਛ ਰਿਜਲਟ ਵਧੀਆ ਨਹੀਂ ਮਿਲੇ ਉਸਦਾ ਕੀ ਹੋਇਆ ਜਦੋਂ ਅਸੀਂ ਇਸਤੇਮਾਲ ਮੈਂ ਨਹੀਂ ਸਾਰੇ ਪਰਿਵਾਰ ਦੇ ਵਿੱਚ ਹੋਰ ਮੈਂਬਰਾਂ ਨੇ ਵੀ ਕੀਤਾ ਤਾਂ ਸਕਿੰਨ ਦੀ ਸਾਨੂੰ ਪ੍ਰੋਬਲਮ ਆਈ ਆ ਇਹ ਸਾਡਾ ਯਾਨੀ ਕਿ ਨੈਗੇਟਿਵ ਪ੍ਰੋਡਕਟ ਦੀ ਜਿਹੜੀ ਕੁਆਲਟੀ ਉਹ ਵਧੀਆ ਨਹੀਂ ਸੀ ਰੇਟ ਜ਼ਿਆਦਾ ਸੀ ਇਹ ਇਹ ਤੁਹਾਡੇ ਨਾਲ ਅਸੀਂ ਵਿਚਾਰ ਸਾਂਝੇ ਕੀਤੇ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ